ਹੈਲੋ ਹਾਂਜੀ ਹਾਂਜੀ ਵੀਰੇ ਉਥੋਂ ਹੀ ਬੋਲਦਾਂ ਜੀ ਕਿਹੜਾ ਵੀਰੇ ਆਪਾਂ ਨੂੰ ਆਈਫੋਨ ਐਕਸ ਆਰ ਪਵੇਗਾ ਵੀਹ ਹਜ਼ਾਰ ਦਾ ਵੀਰੇ ਨਵਾਂ ਲੈਣਾ ਤਾਂ ਪੱਚੀ ਤੋਂ ਤੀਹ ਹਜ਼ਾਰ ਦੇ ਵਿੱਚ ਪੈ ਜੂਗਾ ਬਾਕੀ ਉਪਰਲੇ ਆਪਣੇ ਕੋਲ ਪੰਦਰਾਂ ਪਰੋ ਸਾਰੇ ਪਏ ਕਿਵੇਂ ਕਰਨਾ ਏ ਨਕਦ ਲੈਣਾ ਕਿ ਡਾਉਨ ਪੇਅਮੈਂਟ

ਅੱਛਾ ਜੀ ਅਤੇ ਡਾਉਨ ਪੇਅਮੈਂਟ ਕਿੰਨੀ ਕਰੋਂਗੇ ਦਸ ਹਜ਼ਾਰ

ਠੀਕ ਹਾਂ ਹਾਂ ਕੋਈ ਚੱਕਰ ਨਹੀਂ ਹੈਗਾ ਆਪਣੇ ਕੋਲ ਬਜਾਜ ਫਾਨਾਂਸ ਵੀ ਹੈਗਾ ਏ ਐਚ ਡੀ ਐਫ ਸੀ ਵੀ ਹੈਗਾ ਐਸ ਬੀ ਆਈ ਵੀ ਹੈਗਾ ਆਪਣੇ ਕੋਲ ਫਾਨਾਂਸ ਆਪਣੇ ਕੋਲ ਹੈਗੇ ਨੇ ਕੰਡੀਸ਼ਨ ਕੰਡੀਸ਼ਨ ਵੀਰੇ ਮੇਰੀ ਗੱਲ ਸੁਣੋ ਲੈ ਜਿਓ ਜੇ ਕਿਸੇ ਤਰ੍ਹਾਂ ਦੀ ਖਰਾਬੀ ਹੋ ਗਈ ਵਾਪਸ ਕਰ ਜਿਓ ਹੁਣ ਤਾਂ ਇਹ ਨਹੀਂ ਹੈਗਾ ਆਪਣੇ ਕੋਲ ਆਪਣੇ ਕੋਲ ਪੱਕੀ ਦੁਕਾਨ ਹੈ ਯਾਰ ਆਪਣੀ ਸਾਡੇ ਕੋਲ ਕਿਹੜਾ ਇਹ ਹੈ ਵੀ ਇੱਕ ਦਿਨ ਇੱਧਰ ਇਕ ਦਿਨ ਉੱਧਰ ਦੁਕਾਨ ਪੱਕੀ ਹੈ ਆਪਣੀ ਲੈ ਜਿਓ ਕਿਸੇ ਤਰ੍ਹਾਂ ਦੀ ਕੋਈ ਵੀ ਖਰਾਬੀ ਹੂਗੀ ਨਵੇਂ 'ਚ ਵੀ ਕੋਈ ਖਰਾਬੀ ਹੋਵੇਗੀ ਨਾ ਆਪਾਂ ਬੈਠੇ ਹਾਂ ਨਵਾਂ ਲੈ ਜਿਓ ਚਾਹੇ ਵੀਵੋ ਦਾ ਵੀ ਪੰਦਰਾਂ ਵੀ ਆਇਆ ਹੋਇਆ ਵੀਰੇ ਆਪਣੇ ਕੋਲ ਵੀ ਉੱਨੀ ਵੀ ਹੈਗਾ ਏ ਵੀ ਇੱਕੀ ਵੀ ਹੈਗਾ ਏ ਓਪੋ ਦੇ ਵੀ ਹੈਗੇ ਨੇ ਵਿਚੋ ਲੋਨ ਕਰਵਾ ਲਿਓ ਚਾਹੇ ਉਹ ਦਾ ਵੀ ਹਾਂ ਚਾਹੇ ਵਿੱਚ ਹੀ ਲੋਨ ਕਰਾ ਦਾਂਗੇ ਬਾਈ ਹਾਂ ਹਾਂ ਵਿੱਚੇ ਦੇਦਾਂਗੇ ਬਾਬੇ ਕੋਈ ਚੱਕਰ ਨਹੀਂ ਹੈਗਾ ਰੈਮ ਵਧੀਆ ਹੋਊਗਈ ਬਾਬੇ ਉਹ ਜਿਵੇਂ ਤੂੰ ਲਾਏਂਗਾ ਓਪਨ ਤੇਰਾ ਪੈਸੇ ਲੱਗ ਜਾਣਗੇ ਫੇਰ ਆ ਜਿਓ ਮੈਂ ਮਿਲ ਜਿਓ ਹਾਂ ਅਤੇ ਦੇਖ ਲਿਓ ਆਈਫੋਨ ਤਾਂ ਵੀਰੇ ਚਾਰਜਰ ਤਾਂ ਨਾਲ ਆਉਂਦਾ ਨਹੀਂ ਚੱਲ ਲੈ ਲਈ ਤੂੰ ਹੋਰ ਕੀ ਆ ਹਾਂ ਕੋਈ ਚੱਕਰ ਨਹੀਂ ਹੈਗਾ ਲੈ ਜੀ ਯਾਰ ਮੈਂ ਕਰ ਕੋਈ ਚੱਕਰ ਨਹੀਂ ਕੋਈ ਚੱਕਰ ਨਹੀਂ ਹੈਗਾ ਕਰ ਦੂਂਗਾ ਠੀਕ ਹੈ ਜੀ